ਅਸੀਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਦਰੁਸਤ ਰੱਖਣ ਲਈ ਸਵੇਰੇ ਤੜਕੇ ਉੱਠ ਕੇ ਕਾਫੀ ਦੂਰ ਤੱਕ ਦੌੜ ਵਗੈਰਾ ਲਗਾਉਂਦੇ ਹਨ ਕਈ ਰਹੱਸਲਾਂ ਕਰਕੇ ਜਿਵੇਂ ਕਿ ਰੇਚ ਵਗੈਰਾ ਹੋਰ ਡੰਡ ਬੈਠਕ ਕੱਢ ਕੇ ਰੱਸੇ ਦੇ ਉੱਪਰ ਚੜਨਾ ਲਟਕਣਾ ਜੀ ਕਾਫੀ ਸਰੀਰ ਨੂੰ ਉਹ ਮਿਲ ਸਖਤੀ ਮਿਲਦੀ ਹੈ ਮੇਰੀ ਆਦਤ ਸੀ ਪਹਿਲਾਂ ਤੋਂ ਹੀ ਫੌਜ ਦੇ ਵਿੱਚ ਵੀ ਹੁਣ ਵੀ ਮੈਂ ਉਸੇ ਤਰ੍ਹਾਂ ਕਰਦਾ ਰਹਿਦਾ ਹਾਂ ਕਾਫੀ ਹੌਲੀ ਹੌਲੀ ਕਾਫੀ ਦੂਰ ਤੱਕ ਦੌੜ ਵਧਾਉਣ ਦੀ ਕੋਸ਼ਿਸ਼ ਕਰਦਾ ਹਾਂ ਫਿਰ ਬੜੇ ਆਰਾਮ ਨਾਲ਼ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ਼ ਆਪਣਾ ਓ ਕਰ ਰਹੇ ਹਾਂ ਕੋਈ ਫਿਰ ਰੂਟੀਨ ਵਿੱਚ ਤਾਕਤ ਅਤੇ ਲਚਕਤਾ ਸਪਲਾਈ ਨੂੰ ਸਾਨੂੰ ਉਹ ਮਿਲ ਮਿਲਦਾ ਹੈ ਕਾਫੀ ਜ਼ੋਰ ਵਗੈਰਾ ਲਗਾਉਣਾ ਹੋਰ ਵੀ ਬੱਚਿਆਂ ਨੂੰ ਵੀ ਮੈਂ ਆਦਤ ਪਾਈ ਹੋਈ ਹੈ ਕਿ ਸਵੇਰੇ ਔਰ ਸ਼ਾਮ ਨੂੰ ਜ਼ਰੂਰ ਆਪਣੀ ਐਕਸਰਸਾਈਜਾਂ ਲਈ ਜਾਇਆ ਕਰੋ